ਸਤਿ ਸ਼੍ਰੀ ਅਕਾਲ ਭਾਜੀ ਵਧੀਆ ਭਾਜੀਅ ਵਧੀਆ ਤੁਸੀਂ ਸੁਣਾਓ ਜੀ ਕੀ ਹਾਲ ਚਾਲ ਹੈ ਗੇਮ ਭਾਅ ਜੀ ਵਧੀਆ ਚੱਲਦੀ ਹੈ ਐਨ ਘੈਂਟ ਚੱਲਦੀ ਹੈ ਜੀ ਹਾਂਜੀ ਹਾਂਜੀ ਭਾਜੀ

ਹਾਂਜੀ ਹਾਂਜੀ ਭਾਅ ਜੀ ਪੰਜਾਬ 'ਚ ਤਾਂ ਬਹੁਤ ਅਕੈਡਮੀਆਂ ਹੈ ਭਾਅ ਜੀ ਕਬੱਡੀ ਜਿਹੜੇ ਕਬੱਡੀ ਤਿਆਰੀ ਵਧੀਆ ਕਰਾਂਦੀਆਂ ਹੈਗੀਆਂ ਜੀ ਹਾਂਜੀ ਹਾਂਜੀ ਭਾਅ ਜੀ ਉਹ ਤਾਂ ਹੈਗਾ ਜੀ ਭਾਅ ਜੀ ਇੱਥੇ ਇੱਕ ਭਗਤ ਸਿੰਘ ਅਕੈਡਮੀ ਹੈਗੀ ਨਵਾਂਸ਼ਹਿਰ ਆਪਣੇ ਜੀ ਹਾਂਜੀ ਹਾਂਜੀ ਉੱਧਮ ਸਿੰਘ ਅਕੈਡਮੀ ਜਲੰਧਰ ਹੈਗੀ ਹੈ ਜੀ ਮੈਂ ਵੀ ਉੱਥੋ ਹੀ ਟਰੇਨਿੰਗ ਕੀਤੀ ਆ ਭਾਅ ਜੀ ਬੜੇ ਵਧੀਆ ਬੰਦੇ ਆ ਜੀ ਐਂਡ ਕੌਚ ਸਾਹਿਬ ਵੀ ਬੜੇ ਘੈਂਟ ਹੈ ਜੀ ਉਹ ਭਾਅ ਜੀ ਅਕੈਡਮੀ ਤਾਂ ਪ੍ਰਾਈਵੇਟ ਹੈ ਉੱਦਾ ਉਹ ਪਰ ਇੱਦਾਂ ਹੈ ਭਾਅ ਜੀ ਉਹ ਡਾਈਟ ਵਗੈਰਾ ਦਾ ਵੀ ਬੰਦੇ ਦਾ ਪੂਰਾ ਧਿਆਨ ਰੱਖਦੇ ਹੈਗੇ ਹੈ ਅਤੇ ਪ੍ਰੈਕਟਿਸ ਵੀ ਭਾਅ ਜੀ ਬਹੁਤ ਵਧੀਆ ਕਰਾਂਦੇ ਹੈਗੇ ਕੌਚ ਸਾਹਿਬ ਮਤਲਬ ਕੱਲੀ ਕੱਲੀ ਚੀਜ਼ ਬਾਰੇ ਦੱਸਦੇ ਹੈਗੇ ਵਧੀਆ ਜੀ ਐਨ ਉੱਥੇ ਹਾਂਜੀ ਇਹਨਾਂ ਦੀ ਫ਼ੀਸ ਤਾਂ ਭਾਅ ਜੀ ਇਹ ਪ੍ਰਾਈਵੇਟ ਹੈ ਥੋੜੀ ਜਿਹੀ ਇਹ ਇਹਨਾਂ ਦੀ ਫ਼ੀਸ ਤਾਂ ਜ਼ਿਆਦਾ ਹੋਊਗੀ ਜੀ ਹਾਂਜੀ ਹਾਂਜੀ ਭਾਅ ਜੀ ਇਹ ਤੀਹ ਚਾਲ਼ੀ ਹਜ਼ਾਰ ਰੁਪਇਆ ਪਰ ਮੰਨਥ ਲੈਂਦੇ ਹੈਗੇ ਹੈ ਇਹ ਸਰਕਾਰੀ ਭਾਅ ਜੀ ਫਿਰ ਮੋਹਾਲੀ ਹੈ ਜੀ ਇੱਥੇ ਉਹ ਸਰਕਾਰੀ ਭਾਅ ਜੀ ਮੋਹਾਲੀ ਹੈਗੀ ਹੈ ਜਿਹੜੀ ਉਹ ਜੀ ਰਾਜੀਵ ਰਾਜੀਵ ਗਾਂਧੀ ਅਕੈਡਮੀ ਹਾਂਜੀ ਹਾਂਜੀ ਉਹਨਾਂ ਦੀ ਮਤਲਬ ਜਿਹੜੀ ਫ਼ੀਸ ਹੁੰਦੀ ਹੈ ਬਹੁਤ ਘੱਟ ਹੁੰਦੀ ਹੈਗੀ ਪਰ ਉਹ ਵੀ ਪ੍ਰੈਕਟਿਸ ਵਗੈਰਾ ਐਨ ਵਧੀਆ ਕਰਾਂਦੇ ਹੈਗੇ ਹੈ ਭਾਅ ਜੀ ਉਹ ਤਾਂ ਹਾਂਜੀ ਉੱਥੋ ਖਿਡਾਰੀ ਵੀ ਕਾਫ਼ੀ ਜਿਹੜੇ ਜ਼ਿਆਦਾਤਰ ਜਿਹੜਾ ਮਤਲਬ ਨੈਸ਼ਨਲ ਲੈਵਲ ਦੇ ਜਿਹੜੇ ਖੇਡਣ ਜਾਂਦੇ ਹੈਗੇ ਜ਼ਿਆਦਾਤਰ ਖਿਡਾਰੀ ਭਾਅ ਜੀ ਉੱਥੋ ਹੀ ਸਿਲੈਕਟ ਹੁੰਦੇ ਹੈਗੇ ਹੈ ਉਹ

ਹਾਂਜੀ ਹਾਂਜੀ ਭਾਅ ਜੀ ਉਹਨਾਂ ਦੀ ਫ਼ੀਸ ਵੀ ਮਤਲਬ ਪੰਜ ਚਾਰ ਹਜ਼ਾਰ ਰੁਪਇਆ ਹੈ ਪਰ ਮੰਨਥ ਦੀ ਹਾਂਜੀ ਹਾਂ ਕੋਈ ਗੱਲ ਨੀ ਭਾਅ ਜੀ ਕੋਈ ਗੱਲ ਨੀ ਮੈਂ ਤੁਹਾਨੂੰ ਸੈਂਡ ਕਰ ਦਿੰਦਾ ਜੀ ਤੁਸੀਂ ਕਰ ਲਿਓ ਜੀ ਗੱਲ ਉਹਨਾਂ ਨਾਲ਼ ਹੀ ਓਕੇ ਭਾਅ ਜੀ ਓਕੇ ਜੀ ਵੈਲਕਮ ਜੀ